ਹੈਲੋ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਂਟੀ ਮੈਂ ਤੁਹਾਡੀ ਗੁਆਂਢ ਤੋਂ ਬੋਲਦੀ ਹਾਂ ਅਸੀਂ ਨਵੀਂ ਆਈ ਆ ਨਾ ਹੁਣ ਇੱਕ ਮੈਂ ਤੁਹਾਡਾ ਨੰਬਰ ਲਿਆ ਸੀ ਅੱਜ ਆਪਾਂ ਪਾਰਕ ਵਿੱਚ ਮਿਲੇ ਸੀ ਹਾਂਜੀ ਅਤੇ ਉਹ ਆਂਟੀ ਮੈਂ ਪੁੱਛਣਾ ਸੀਗਾ ਹੁਣ ਸਰਦੀ ਆ ਗਈ ਆ ਅਤੇ ਵੀ ਬਾਜ਼ਾਰ 'ਚੋਂ ਇਥੋਂ ਬਾਰੇ ਮੈਨੂੰ ਪਤਾ ਨਹੀਂ ਬਾਹਰੋਂ ਆਏ ਕਰਕੇ ਸ਼ੋਪਿੰਗ ਕਰਨੀ ਸੀਗੀ ਕੋਟੀਆਂ ਵਗੈਰਾ ਸ਼ਾਲ ਵਗੈਰਾ ਲੈਣੇ ਸੀ ਹਾਂਜੀ ਕੋਈ ਸ਼ੋਪਸ ਵਗੈਰਾ ਬਾਰੇ ਸਾਨੂੰ ਜੇ ਤੁਸੀਂ ਦੱਸਦੇ ਹੋ ਹਾਂਜੀ

ਹਾਂਜੀ

ਠੀਕ ਹਾਂਜੀ ਹਾਂਜੀ ਉਹ ਫਿਰ ਹਾਂਜੀ ਹਾਂਜੀ ਹਾਂਜੀ

ਹਾਂਜੀ ਅਤੇ ਆਂਟੀ ਕੋਈ ਵੀ ਜਿਵੇਂ ਆਪਾਂ ਉੱਨ ਵਗੈਰਾ ਖਰੀਦਣੀ ਹੋਵੇ ਵੀ ਕੋਈ ਉਹਦੀ ਸ਼ੋਪ ਹੋ ਗਈ ਉਹ ਕਿੱਥੇ ਹੈਗੀ ਬਣਾਉਣਾ ਵੀ ਆ ਕੋਈ ਬਣਾਉਂਦਾ ਹੋਵੇ

ਠੀਕ ਹੈ ਜੀ

ਠੀਕ ਅਤੇ ਆਂਟੀ ਵਧੀਆ ਬਣਾ ਦਿੰਦੇ ਉਹ ਐਂ ਤਾਂ ਨਹੀਂ ਵੀ ਜਿਵੇਂ ਉਹ ਢਿੱਲੀ ਢਿੱਲੀ ਜੀ ਬੁਣ ਦਿੰਦੇ ਹੋਣ ਤੁਸੀਂ ਅੱਛਾ ਤੁਸੀਂ ਹਾਂਜੀ ਨਹੀਂ ਕੋਈ ਗੱਲ ਨਹੀਂ ਆਂਟੀ ਕੋਈ ਨਹੀਂ ਅਸੀਂ ਆ ਕੇ ਨਾ ਕਿਸੇ ਦਿਨ ਵੇਖ ਲਾਂਗੇ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਆਵਾਂਗੇ ਜੀ ਜ਼ਰੂਰ ਫਿਰ ਐਂ ਆ ਨਾ ਅਸੀਂ ਨਵੇਂ ਆਏ ਕਰਕੇ ਸਾਨੂੰ ਸ਼ਹਿਰ ਬਾਰੇ ਨੌਲੇਜ ਨੀਗੀ ਮੈਂ ਤਾਂ ਹੀ ਇਹਨਾਂ ਕੋਲ ਕੀਤੀ ਇਹ ਕਹਿੰਦੇ ਤੁਸੀਂ ਆਂਟੀ ਤੋਂ ਫੋਨ ਕਰਕੇ ਪੁੱਛ ਲਓ ਉਹਨਾਂ ਨੂੰ ਤਾਂ ਪਤਾ ਹੈਗਾ ਅਤੇ ਹਾਂਜੀ ਕੋਈ ਗੱਲ ਨਹੀਂ ਆਪਾਂ ਤੁਹਾਡੇ ਤੋਂ ਹੀ ਬਣਵਾ ਲਵਾਂਗੇ ਆਪਾਂ ਫਿਰ ਬਾਜ਼ਾਰ 'ਚ ਜ਼ਰੂਰ ਜਾਣਾ ਹਾਂਜੀ

ਹਾਂਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਆਪਾਂ ਵੇਖਾਂਗੇ ਹਾਂਜੀ ਹਾਂਜੀ ਪਸੰਦ ਆਈ ਆ ਅਤੇ ਤੁਹਾਡੇ ਤੋਂ ਕਰਵਾਵਾਂਗੇ ਚਲੋ ਠੀਕ ਹੈ ਜੀ ਮੈਂ ਆਊਂਗੀ ਕਿਸੇ ਦਿਨ ਆਂਟੀ ਓਕੇ ਜੀ ਓਕੇ ਓਕੇ ਠੀਕ ਹੈ